ਅੱਜ ਕੱਲ੍ਹ ਬਿਜਲੀ ਦੇ ਕੱਟ ਸਰਦੀ ਦੇ ਮੌਸਮ ਵਿੱਚ ਘੱਟ ਲੱਗਦੇ ਨੇ ਅੱਧਾ ਪੌਣਾ ਘੰਟਾ ਲਾਈਟ ਜਾਂਦੀ ਹੈ ਦਿਨ ਦੇ ਵਿੱਚ ਅਤੇ ਬਹੁਤ ਵਧੀਆ ਬਿਜਲੀ ਦਾ ਪਰੌਸੈਸ ਚੱਲ ਰਿਹਾ ਜੀ ਮੋਬਾਇਲ ਵਗੈਰਾ ਚਾਰਜਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਗਾ ਹਾਂ ਗਰਮੀ ਦੇ ਵਿੱਚ ਹੁੰਦਾ ਕਿ ਗਰਮੀ ਕਾਰਨ ਜ਼ਿਆਦਾ ਬਿਜਲੀ ਜਾਂਦੀ ਆ ਫਿਰ ਮੋਬਾਇਲ ਵੀ ਰਚਾਰਜ ਨਹੀਂ ਹੁੰਦੇ ਟੀ ਵੀ ਚਲਾਉਣ ਵਿੱਚ ਵੀ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਤਾਂ ਇੰਨਵਰਟਰ ਵੀ ਬੰਦ ਹੋ ਜਾਂਦਾ ਹੈ ਜਿਹਦੇ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਗਰਮੀ ਦੇ ਮੌਸਮ 'ਚ ਜਦੋਂ ਲਾਈਟ ਚਲੀ ਜਾਂਦੀ ਜੀ ਬਜ਼ੁਰਗਾਂ ਨੂੰ ਬੜ ਬਹੁਤ ਔਖਾ ਹੁੰਦਾ ਹੈ ਜੀ ਪਰ ਹੁਣ ਕਾਫ਼ੀ ਸੁਧਾਰ ਆ ਗਿਆ ਪਹਿਲਾਂ ਨਾਲੋਂ ਪਟਿਆਲੇ ਵਿੱਚ ਤਾਂ ਬਹੁਤ ਘੱਟ ਲੱਗਦੇ ਨੇ ਜੀ ਕੱਟ ਬਿਜਲੀ ਦੇ ਪਹਿਲਾਂ ਜ਼ਿਆਦਾ ਲੱਗਦੇ ਸੀ ਸਰਦੀ ਦੇ ਮੌਸਮ ਵਿੱਚ ਬਿਲਕੁਲ ਹੀ ਘੱਟ ਲੱਗਦੇ ਨੇ ਕੱਟ ਅਤੇ ਹੁਣ ਠੀਕ ਹੈ ਜੀ ਅੱਜ ਅੱਜ ਕੱਲ੍ਹ ਤਾਂ ਮੌਸਮ ਹੈ ਜਿਹੜਾ ਉਹ ਬਹੁਤ ਵਧੀਆ ਜੀ ਕੱਟ ਬਹੁਤ ਘੱਟ ਲੱਗਦੇ ਨੇ